ਸਤਿ ਸ਼੍ਰੀ ਅਕਾਲ ਹਾਂਜੀ ਜੀ ਬਿਲਕੁਲ ਸੁਰਜੀਤ ਸਿੰਘ ਸੇ ਹੋ ਰਹੀ ਹੈ ਹਾਂਜੀ ਹਾਂਜੀ ਹਾਂਜੀ ਬਿਲਕੁਲ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਜ ਲੱਖ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਮੰਥਲੀ ਹੀ ਆ ਹਾਂਜੀ ਹਾਂਜੀ ਓਕੇ ਓਕੇ ਓਕੇ ਓਕੇ